ਪੁਰਾਣੇ ਲੋਕ ਪਿਛਲੇ ਜ਼ਮਾਨੇ ਦੇ ਉਹ ਲੋਕ ਸਾਰਾ ਕੰਮ ਆਪਣਾ ਹੱਥ ਨਾਲ ਕਰਦੇ ਸੀ ਜਿਵੇਂ ਕਿ ਦੁੱਧ ਰਿੜਕਣਾ ਸਾਰਾ ਕੰਮ ਰੋਟੀ ਬਣਾਉਣੀ ਸਾਰਾ ਕੰਮ ਹੀ ਹੱਥ ਨਾਲ ਹੁੰਦਾ ਸੀ ਹੁਣ ਇੰਨੀ ਤਰੱਕੀ ਹੋ ਗਈ ਹੈ ਕਿ ਮਸ਼ੀਨੀ ਯੁੱਗ ਆ ਗਿਆ ਹੈ ਇਸ ਕਰਕੇ ਸਾਰਾ ਕੰਮ ਮਸ਼ੀ ਬਿਜਲੀ ਵਾਲਾ ਚਲ ਗਿਆ ਹੈ ਜਿਵੇਂ ਕਿ ਦੁੱਧ ਰਿੜਕਣਾ ਬੱਤੀ ਵਾਲੀ ਰਸੋਈ ਦਾ ਸਾਰਾ ਕੰਮ ਜਿਵੇਂ ਗੀਜਰ ਅ ਆਰ ਓ ਹੀਟਰ ਚਿਮਣੀ ਇਹ ਸਾਰਾ ਕੰਮ ਬਿਜਲੀ ਦਾ ਹੈ ਸਾਡੀ ਰਸੋਈ ਦੇ ਵਿੱਚ ਸਾਰੇ ਸੁਵਿਧਾ ਹੈ ਜਿਹੜੀਆਂ ਸਾਨੂੰ ਹੁਣ ਮਿਲਦੀਆਂ ਹਨ ਜੋ ਪਿੱਛੇ ਲੋਕਾਂ ਨੂੰ ਨਹੀਂ ਸੀ ਮਿਲਦੀਆਂ ਹੁਣ ਵਾਲੇ ਤਰੀਕੇ ਵੱਖਰੇ ਨੇ ਅਤੇ ਉਦੋਂ ਵਾਲੇ ਤਰੀਕੇ ਵੱਖਰੇ ਸੀ ਜਿਵੇਂ ਗੈਸ ਸਲੰਡਰ ਲੋਕ ਬੀਬੀਆਂ ਚੁੱਲ੍ਹੇ 'ਤੇ ਕੰਮ ਕਰਦੀਆਂ ਸੀ ਹੁਣ ਲੋਕ ਗੈਸ ਸਲੰਡਰ 'ਤੇ ਕਰਦੀਆਂ ਨੇ ਮਿਕਸੀ ਵਿੱਚ ਜੋ ਵੀ ਕੰਮ ਕਰਦੀਆਂ ਸੀ ਪਹਿਲਾਂ ਹੱਥ ਨਾਲ ਕਰਦੀਆਂ ਸੀ ਹੁਣ ਮਿਕਸੀ ਵਿੱਚ ਕਰਦੀਆਂ ਨੇ ਗੁਰੈਂਡਰ ਵਿਚ